ਜਾਨਵਰਾਂ ਨਾਲ ਸਾਡਾ ਰਿਸ਼ਤਾ ਬਹੁਤ ਹੀ ਗਹਿਰਾ ਹੈ ਕਿਉਂਕਿ ਅਸੀਂ ਆਪਣੇ ਘਰ ਵਿੱਚ ਇੱਕ ਕੁੱਤਾ ਰੱਖਦੇ ਹਾਂ ਜੋ ਸਾਨੂੰ ਬਹੁਤ ਪਸੰਦ ਹੈ ਉਹ ਸਾਡੇ ਘਰ ਦੀ ਬਹੁਤ ਹੀ ਰਾਖੀ ਰੱਖਦਾ ਹੈ ਉਹ ਰਾਤ ਨੂੰ ਸਾਰੀ ਰਾਤ ਰਾਖੀ ਰੱਖਦਾ ਹੈ ਅਸੀਂ ਉਸ ਦੀ ਬਹੁਤ ਚੰਗੀ ਦੇਖਭਾਲ ਕਰਦੇ ਹਾਂ ਉਸਨੂੰ ਰੋਟੀ ਪਾਉਂਦੇ ਹਾਂ ਲੱਸੀ ਪੀਂਦਾ ਹੈ ਦੁੱਧ ਪਾਉਂਦੇ ਹਾਂ ਜਾਨਵਰ ਸਾਡੇ ਲਈ ਬਹੁਤ ਚੰਗੇ ਹੁੰਦੇ ਹਨ ਕਿਉਂਕਿ ਉਹ ਸਾਡੇ ਪਰਿਵਾਰ ਦੇ ਮੈਂਬਰਾਂ ਵਾਂਗੂੰ ਹੀ ਬਣ ਜਾਂਦੇ ਹਨ ਅਸੀਂ ਉਹ ਆਪਣੇ ਪਰਿਵਾਰ ਦਾ ਮੈਂਬਰ ਹੀ ਮੰਨਦੇ ਹਾਂ ਕਿਉਂਕਿ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੁੰਦੇ ਹਨ ਜੇ ਆਪਾਂ ਜਾਨਵਰਾਂ ਨਾਲ ਰਿਸ਼ਤਾ ਚੰਗਾ ਰੱਖਦੇ ਹਾਂ ਤਾਂ ਉਹ ਆਪਣੇ ਨਾਲ ਵੀ ਆਪਣਾ ਰਿਸ਼ਤਾ ਚੰਗਾ ਕਾਇਮ ਕਰਦੇ ਹਨ ਜਾਨਵਰਾਂ ਦੀ ਦੇਖਭਾਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਾਨਵਰ ਸਾਡੇ ਲਈ ਬਹੁਤ ਹੀ ਚੰਗੇ ਹੁੰਦੇ ਹਨ ਉਹ ਸਾਡੇ ਨਾਲ ਦੋਸਤਾਂ ਵਾਂਗ ਰਹਿੰਦਾ ਹੈ ਉਹ ਬਹੁਤ ਹੀ ਚੰਗਾ ਹੈ ਸਾਨੂੰ ਬਹੁਤ ਚੰਗਾ ਲੱਗਦਾ ਹੈ ਥੈਂਕ ਯੂ